ਜੇ ਦੇਖਿਆ ਜਾਵੇ ਤਾਂ ਸਾਡੇ ਰੋਪੜ ਸ਼ਹਿਰ ਵਿੱਚ ਲੜਕੀਆਂ ਨੂੰ ਬਹੁਤੀ ਸਿੱਖਿਆ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਬਹੁਤਾ ਪੜ੍ਹਾਇਆ ਲਿਖਾਇਆ ਜਾਂਦਾ ਹੈ ਇਸ ਦੇ ਬਦਲੇ ਔਰ ਲੜਕਿਆਂ ਨੂੰ ਜ਼ਿਆਦਾ ਪੜਾਉਂਦੇ ਲਿਖਾਉਂਦੇ ਹਨ ਅਤੇ ਲੜ ਮਤਲਬ ਕਿ ਬਹੁਤ ਪਹਿਲ ਦਿੱਤੀ ਜਾਂਦੀ ਹੈ ਲੜਕਿਆਂ ਨੂੰ ਅਤੇ ਲੜਕੀਆਂ ਨੂੰ ਘਰ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਇਸ ਕਰਕੇ ਉਹ ਸਮਾਜਿਕ ਖੇਤਰ ਵਿੱਚ ਵੀ ਲੜਕੀਆਂ ਨੂੰ ਪਹਿਲ ਨਹੀਂ ਦਿੰਦੇ ਅਤੇ ਭਰੂਣ ਭਰੂਣ ਹੱਤਿਆ ਕਰਦੇ ਹਨ ਅਤੇ ਲ ਲੜਕਿਆਂ ਔਰ ਲੜਕੇ ਅਤੇ ਲੜਕੀਆਂ ਵਿੱਚ ਵਿਤਕਰਾ ਕਰਦੇ ਹਨ ਕਈ ਲੋਕ ਤਾਂ ਲੜਕ ਲੜਕਿਆਂ ਦੀ ਲੋਹੜੀ ਮਨਾਉਂਦੇ ਹਨ ਅਤੇ ਲੜਕੀਆਂ ਨੂੰ ਕੁੱਖ ਦੇ ਵਿੱਚ ਮਾਰ ਦਿੰਦੇ ਹਨ ਲੜਕੀਆਂ ਨਾਲ ਤਾਂ ਬਹੁਤ ਇਸ ਕਰਕੇ ਲੜਕੀਆਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ